ਭਾਰਤੀ ਆਵਾਜਾਈ ਪ੍ਰਣਾਲੀ ਖਾਮ ਆਮ ਤੌਰ 'ਤੇ ਜਿਹੜੀ ਹੈਗੀ ਹੈ ਸਾਡੇ ਲੋ ਸ਼ਹਿਰਾਂ ਦੇ ਵਿੱਚ ਬਹੁਤ ਵਧੀਆ ਦੇਖਣ ਨੂੰ ਮਿਲਦੀ ਹੈਗੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਵਧੀਆ ਆਵਾਜਾਈ ਪ੍ਰਣਾਲੀ ਹੈ ਬਟ ਜੇਕਰ ਹੋਰ ਜਗ੍ਹਾ ਦੇ ਵਿੱਚ ਆਪਾਂ ਦੇਖਣ ਜਾਈਏ ਜਿਵੇਂ ਕਿ ਦਿੱਲੀ ਬੰਬੇ ਔਰ ਹੋਰ ਆਦਿ ਵੱਡੇ ਸ਼ਹਿਰਾਂ ਦੇ ਵਿੱਚ ਇਹ ਆਵਾਜਾਈ ਪ੍ਰਣਾਲੀ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਇਹ ਇਹਦੇ ਵਿੱਚ ਸੁਧਾਰ ਕਰਨ ਦੀ ਲੋੜ ਹੈਗੀ ਹੈ ਅਤੇ ਉੱਥੇ ਬਹੁਤ ਸਾਰੀਆਂ ਲਾਈਟਸ ਹੁੰਦੀਆਂ ਨੇ ਅਤੇ ਬਹੁਤ ਸਾਰਾ ਟਰੈਫਿਕ ਹੁੰਦੀ ਹੈ ਜਿਸ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਆਵਾਜਾਈ ਦੇ ਵਿੱਚ ਸਟਰੱਕ ਹੋਣ ਦੇ ਵਿੱਚ ਕਾਫੀ ਜ਼ਿਆਦਾ ਸਮਾਂ ਉਹਨਾਂ ਦਾ ਬਰਬਾਦ ਹੁੰਦਾ ਆ ਅਤੇ ਇਸ ਸੁਧਾਰ ਇਸਦੇ ਸੁਧਾਰ ਕਰਨ ਵਾਸਤੇ ਗੌਰਮਿੰਟ ਨੂੰ ਓਡ ਈਵਨ ਫੰਕਸ਼ਨ ਜਿਹੜਾ ਸ਼ ਸਿਸਟਮ ਸ਼ੁਰੂ ਕੀਤਾ ਸੀਗਾ ਕੇਜਰੀਵਾਲ ਜੀ ਨੇ ਉਹਦੇ ਬਾਰੇ ਜਿਹੜਾ ਹੈਗਾ ਸੁਧਾਰ ਕਰਨ ਦੀ ਲੋੜ ਹੈਗੀ ਹੈ ਅਤੇ ਉਸ ਨੂੰ ਅਪਲਾਈ ਕਰਕੇ ਅਸੀਂ ਇਸ ਦਾ ਸੁਧਾਰ ਕਰ ਸਕਦੇ ਹਾਂ